ਮੈਂ ਅਭੀ ਦੇ ਘਰ ਤੋਂ ਗੱਲ ਕਰਦਾ ਸੀਗਾ ਦੇ ਫਾਦਰ ਗੱਲ ਕਰਦਾ ਸੀ ਹਾਂਜੀ ਮੈਮ ਬਸ ਸਕੂਲ ਦੇ ਰਿਗਾਡਿੰਗ ਥੋੜ੍ਹੀ ਡਿਸਕਸ ਕਰਨੀ ਸੀ ਗੱਲ ਵੀ ਕਿਹੜਾ ਸਕੂਲ ਵਧੀਆ ਹੈ ਕਿਸ ਹਿਸਾਬ ਦਾ ਕਿਹੜਾ ਪਾਈਏ ਅੱਛਾ ਹੂੰ ਹੂੰ ਠੀਕ ਹੈ ਓਕੇ ਓਕੇ ਇਹ ਕੌਨਵੈਂਟ ਔਰ ਦੂਸਰੇ ਅਲੱਗ ਅਲੱਗ ਹੁੰਦੇ ਕੁਛ ਕੌਨਵੈਂਟ 'ਚ ਫਰਕ ਹੁੰਦਾ ਕੁਛ ਓਕੇ ਠੀਕ ਹੈ ਠੀਕ ਹੈ ਬਰਡਨ ਜ਼ਿਆਦਾ ਠੀਕ ਹੈ ਠੀਕ ਹੈ ਹਮ ਹਮ ਠੀਕ ਹੈ ਫੇਰ ਮਤਲਬ ਉਸ ਅਕੋਰਡਿੰਗ ਹੀ ਸਕੂਲ ਦੇਖਿਆ ਜਾਏ ਵਧੀਆ ਵੀ ਕਿਹੜਾ

ਹਾਂਜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੈਂਟਲੀ ਵੀ ਹੈਲਪ ਹਮ ਹਮ

ਨਹੀਂ ਸਈ ਗੱਲ ਹੈ ਬੱਚੇ ਦਾ ਜਿੱਧਰ ਇੰਟ੍ਰਸਟ ਹੈ ਉੱਧਰ ਵੀ ਸਹੀ ਹੋਣਾ ਚਾਹੀਦਾ ਹਮ ਹਮ ਨਹੀਂ ਕੋਰਸ 'ਤੇ ਗਏ ਹਲੇ ਤਾਂ ਅਤੇ ਤਾਂ ਹੀ ਮੈਂ ਅੱਗੇ ਫਰਦਰ ਸਟੱਡੀ ਤੌਰ 'ਤੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਲੈਣੀ ਸੀ ਵੀ ਕਿਹੜਾ ਸਕੂਲ ਜ਼ਿਆਦਾ ਵਧੀਆ ਰਹੇਗਾ ਉਹਦੇ ਵਾਸਤੇ ਹਾਂ ਸਟਾਫ਼ ਤਾਂ ਹਮ ਕੋਪਰੇਟਿਵ ਹੋਵੇ ਤਾਂ ਹਾਂਜੀ ਹਾਂਜੀ ਸਾਰੀ ਚੀਜ਼ ਦੇਖ ਹੁੰਦੀ ਜੀ ਠੀਕ ਹੈ ਹਮ ਨਹੀਂ ਸਹੀ ਹੈ ਆਪਾਂ ਸਾਰਾ ਕੁਛ ਦੇਖ ਕੇ ਚੇਂਜ ਕਰਨਾ ਪਏਗਾ ਨਾ ਔਰ ਫੀਸ ਰਿਗਾਡਿੰਗ ਹਮ ਹਮ ਹਾਂਜੀ ਹਾਂਜੀ ਹਮ ਹਮ ਹਾਂ ਸਾਰਾ ਕੁਛ ਦੇਖ ਕੇ ਕਰਨਾ ਪਏਗਾ ਉਹ ਤਾਂ ਸਹੀ ਗੱਲ ਹੈ ਹਮ ਮਤਲਬ ਬਰਡਨ ਵਗੈਰਾ ਤਾਂ ਨਹੀਂ ਪਾਉਂਦੇ ਬੱਚੇ ਉੱਤੇ

ਹਾਂ ਵੀ ਥੋੜ੍ਹਾ ਸੇਫ ਵੀ ਹੋਵੇ ਵੀ ਬੱਚੇ ਨੂੰ ਛੱਡਣਾ ਕਰਨਾ ਲੈਣਾ ਕਰਨਾ ਠੀਕ ਹੈ ਕੋਈ ਵਹੀਕਲ ਵਗੈਰਾ ਦਾ ਅਰੇਂਜਮੈਂਟ ਵੀ ਹੁੰਦਾ ਵਹੀਕਲ ਵਗੈਰਾ ਦਾ ਅਰੇਂਜਮੈਂਟ ਵੀ ਹੁੰਦਾ ਸਕੂਲ ਵੱਲੋਂ ਕੋਈ ਬੱਚੇ ਨੂੰ ਲੈਣ ਕਰਨ 'ਚ ਠੀਕ ਹੈ ਬਾਕੀ ਤਾਂ ਆਪ ਛੱਡਣ ਜਾ ਸਕਦੇ ਆਪਦੀ ਮਰਜ਼ੀ ਹੋਏ ਤਾਂ ਠੀਕ ਹੈ ਠੀਕ ਓਕੇ ਓਕੇ ਔਰ ਰਿਫਰੈਸ਼ਮੈਂਟ ਵਗੈਰਾ ਦਾ ਕੋਈ ਹੋਏਗਾ ਹਿਸਾਬ ਹੈ ਨਾ ਉੱਥੇ ਠੀਕ ਹੈ ਕੈਂਟੀਨਸ ਵਗੈਰਾ ਹੋਣਗੀਆਂ ਉੱਥੇ ਹੈ ਨਾ ਮਤਲਬ ਹਾਂ ਉਹ ਤਾਂ ਥੋੜ੍ਹਾ ਜਾ ਕੇ ਪ੍ਰਿੰਸੀਪਲ ਨਾਲ ਵੀ ਆਪਾਂ ਗੱਲ ਵਗੈਰਾ ਕਰ ਕਰ ਸਕਦੇ ਹਾਂ ਨਾ ਹਾਂ ਬੱਚੇ ਦਾ ਇੰਟ੍ਰਸਟ ਦੇਖ ਦੇਖਦਾਂ ਹਮ ਹਮ ਹਾਂ ਉਹ ਤਾਂ ਜਾ ਸਕਦੇ ਕੋਈ ਗੱਲ ਕਰ ਸਕਦੇ ਹਾਂਜੀ ਠੀਕ ਹੈ ਠੀਕ ਹੈ ਥੈਂਕ ਊ